ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਹਾਂਜੀ ਤਾਂ ਸਭ ਤੋਂ ਪਹਿਲਾਂ ਜਿਹੜਾ ਇਸ ਨਾਲ ਬੱਚਿਆਂ ਦੇ ਪੜ੍ਹਾਈ 'ਤੇ ਬਹੁਤ ਜ਼ਿਆਦਾ ਨੁਕਸਾਨ ਪਿਆ ਕਿਉਂਕਿ ਜਦ ਬਾਰਿਸ਼ ਹੋ ਰਹੀ ਸੀ ਪਾਣੀ ਖੜ੍ਹਨ ਦੇ ਕਾਰਨ ਬੱਚੇ ਸਕੂਲ ਨਹੀਂ ਜਾ ਪਾ ਰਹੇ ਸੀ ਅਤੇ ਔਨਲਾਈਨ ਕਲਾਸਿਸ ਵੀ ਨਹੀਂ ਲੱਗ ਰਹੀ ਸੀਗੀਆਂ ਕਿਉਂਕਿ ਬਾਰਿਸ਼ ਕਾਰਨ ਨੈਟਵਰਕ ਈਸ਼ੂ ਵੀ ਬਹੁਤ ਆ ਰਹੇ ਸੀ ਹੈ ਨਾ ਅਤੇ ਜਿਹੜੇ ਪ੍ਰਾਈਵੇਟ ਜੋਬ ਕਰਦੇ ਨੇ ਉਹਨਾਂ 'ਤੇ ਵੀ ਬਹੁਤ ਜ਼ਿਆਦਾ ਅਸਰ ਪਿਆ ਹੈਗਾ ਕਿਉਂਕਿ ਇਹਨਾਂ ਨੂੰ ਹਰ ਇੱਕ ਹਾਲਤ ਵਿੱਚ ਕੰਮ 'ਤੇ ਜਾਣਾ ਹੀ ਪੈਂਦਾ ਗਾ ਅਤੇ ਇਹਦਾ ਸਭ ਤੋਂ ਵੱਡਾ ਕਾਰਨ ਜਿਹੜਾ ਸਭ ਤੋਂ ਪਹਿਲਾਂ ਆਪਣੇ ਜਿਹੜੇ ਰੁੱਖ ਨੇ ਆਪਾਂ ਬੇਫਜ਼ੂਲੀ ਤੌਰ 'ਤੇ ਕੱਟੀ ਜਾਂਦੇ ਹਾਂ ਨਾ ਕੋਈ ਇੱਕ ਪਰਸੈਂਟ ਬੰਦਾ ਵੀ ਨਹੀਂ ਹੈਗਾ ਜਿਹੜਾ ਲਾਉਂਦਾ ਹੈਗਾ ਅਤੇ ਆਪਾਂ ਕੱਟਣ 'ਤੇ ਜ਼ਿਆਦਾ ਜ਼ੋਰ ਦਿੱਤਾ ਹੋਇਆ ਹੈਗਾ ਜਿਸ ਕਾਰਨ ਜਿਸ ਕਾਰਨ ਇਹ ਮੀਂਹ ਜ਼ਿਆਦਾ ਹੋ ਰਿਹਾ ਹੈਗਾ ਅਤੇ ਇਸ ਨਾਲ ਆਪਾਂ ਨੂੰ ਕੁਦਰਤੀ ਆਫਤਾਂ ਦੀ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਆ ਇਸ ਇਸ ਤੋਂ ਨਿਪਟਣ ਲਈ ਆਪਾਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ ਓਕੇ ਥੈਂਕ ਯੂ